ਹੈਲੋ ਹਾਂਜੀ ਕੌਣ ਮੈਮ ਹਾਂਜੀ ਓਕੇ ਓਕੇ ਹਾਂਜੀ ਮੈਮ ਦੱਸੋ ਹਾਂਜੀ ਜੀ ਹਾਂਜੀ ਓਕੇ ਓਕੇ ਮੈਮ ਤੁਸੀਂ ਜਿਵੇਂ ਬਰਤਨ ਹੁਣ ਜਿਵੇਂ ਮੌਸਮ ਚੇਂਜ ਹੋ ਰਿਹਾ ਹੈ ਸ ਗਰਮ ਸਰਦੀ ਹੈ ਸੋਰੀ ਤੁਸੀਂ ਫਿਰ ਗਰਮ ਪਾਣੀ ਦਿਉਂਗੇ ਓਕੇ ਓਕੇ ਮੈਮ ਮੈਮ ਜੇ ਤੁਹਾਡੀ ਫਰਨੈਲ ਕਿੱਥੇ ਪਈ ਹੁੰਦੀ ਹੈ ਜਿਵੇਂ ਤੁਸੀਂ ਪੋਚਾ ਫਰਨੈਲ ਪਾ ਕੇ ਯੂਜ਼ ਕਰਦੇ ਹੋ ਹਾਂਜੀ ਹਾਂਜੀ ਓਕੇ ਓਕੇ ਮੈਮ ਜੀ ਠੀਕ ਹੈ ਜੀ ਮੈਮ ਜੀ ਮੈਮ ਠੀਕ ਹੈ ਜੀ ਓਕੇ ਝਾੜੂ ਮੈਮ ਸ਼ਾਮ ਨੂੰ ਓਕੇ ਮੈਮ ਠੀਕ ਹੈ ਠੀਕ ਹੈ ਮੈਮ ਅਸੀਂ ਮੌਰਨਿੰਗ ਮੌਰਨਿੰਗ ਕਰ ਦਿਆਂ ਕਰਾਂਗੇ ਠੀਕ ਮੈਮ ਆ ਜਾਂਗੇ ਜੀ ਧੰਨਵਾਦ